ਅੱਜ ਦੇ ਸਮੇਂ ਵਿੱਚ ਵੱਧਦੀ ਅਬਾਦੀ ਕਰਕੇ ਅਪਰਾਧ ਵੀ ਓਨੇ ਹੀ ਵੱਧ ਰਹੇ ਹਨ ਪ੍ਰਸ਼ਾਸ਼ਨ ਨੇ ਅਪਰਾਧਾਂ ਉੱਤੇ ਕਾਬੂ ਕਰਨ ਲਈ ਸਖ਼ਤ ਕਦਮ ਚੁੱਕੇ ਹਨ ਅਤੇ ਸਖ਼ਤ ਨਿਯਮ ਬਣਾਏ ਹਨ ਜ਼ਿਆਦਾਤਰ ਲੋਕ ਇਹ ਗਰੀਬੀ ਕਰਕੇ ਹੀ ਕਰਦੇ ਹਨ ਉਹ ਆਪਣੀ ਭੁੱਖ ਨੂੰ ਮਿਟਾਉਣ ਲਈ ਚੋਰੀ ਡਾਕੇ ਆਦਿ ਅਤੇ ਕਦਮ ਚੁੱਕਦੇ ਹਨ ਅੱਜ ਦੇ ਸਮੇਂ ਵਿੱਚ ਬੇਰੁਜ਼ਗਾਰੀ ਵੀ ਇੱਕ ਅਹਿਮ ਮੁੱਦਾ ਬਣ ਗਿਆ ਹੈ ਰੋਜ਼ਗਾਰ ਦੇ ਸਾਧਨ ਘੱਟਦੇ ਜਾ ਰਹੇ ਹਨ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ ਗਰੀਬ ਗਰੀਬ ਹੋ ਰਿਹਾ ਹੈ ਅਮੀਰ ਅਮੀਰ ਹੋ ਰਿਹਾ ਹੈ ਲੋਕ ਗਰੀਬ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਅਪਰਾਧ ਵਾਲੇ ਰਸਤੇ ਚੁਣ ਲੈਂਦੇ ਹਨ